ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਜੀ ਤੁਸੀਂ ਕਿੱਥੋਂ ਬੋਲਦੇ ਹੋ ਜੀ ਠੀਕ ਹੈ ਜੀ ਅੱਜ ਤਾਂ ਜੀ ਇਹ ਮੁਸ਼ਕਿਲ ਹੈ ਜੀ ਠੀਕ ਹੈ ਜੀ ਅਗਰ ਹੋਇਆ ਤਾਂ ਮੈਂ ਸ਼ਾਮ ਤੱਕ ਆਜੂੰਗਾ ਨਹੀਂ ਕੱਲ੍ਹ ਤਾਂ ਮੈਂ ਦਸ ਵਜੇ ਤੱਕ ਤੁਹਾਡੇ ਘਰਾਂ ਪਹੁੰਚ ਜੂੰਗਾ ਜੀ ਠੀਕ ਹੈ ਠੀਕ ਹੈ ਜੀ